ਫਤਿਹਗੜ੍ਹ ਸਾਹਿਬ ਇੱਕ ਸਿੱਖਾਂ ਦਾ ਵੱਡਾ ਧਰਮ ਸਥਾਨ ਹੈ ਅਤੇ ਇੱਥੇ ਬਹੁਤ ਸਾਰੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਜਿਹਦੇ ਅੰਦਰ ਸਭ ਧਰਮਾਂ ਦੇ ਲੋਕ ਸਾਂਝੇ ਤੌਰ 'ਤੇ ਰਲ ਮਿਲ ਕੇ ਭਾਗ ਲੈਂਦੇ ਹਨ ਸਭ ਤੋਂ ਵੱਡਾ ਜਿਹੜਾ ਸਮਾਗਮ ਹੈ ਉਹ ਦਸੰਬਰ ਦੇ ਆਖਰੀ ਹਫਤੇ ਦੇ ਦੌਰਾਨ ਹੁੰਦਾ ਹੈ ਇਹ ਸ਼ਹੀਦੀ ਜੋੜ ਮੇਲਾ ਜਾਂ ਇਹਨੂੰ ਸਭਾ ਕਹਿ ਦਿੱਤਾ ਜਾਂਦਾ ਇਸ ਸਮੇਂ ਪੂਰੇ ਪੰਜਾਬ ਭਰ ਪੂਰੇ ਭਾਰਤ ਭਰ ਅਤੇ ਭਾਰਤ ਤੋਂ ਬਾਹਰ ਤੋਂ ਵੀ ਸੰਗਤਾਂ ਆ ਕੇ ਜੁੜਦੀਆਂ ਹਨ ਇਹ ਜਿਹੜੇ ਆਖਰੀ ਤਿੰਨ ਦਿਨ ਹਨ ਇੱਥੇ ਇਹਨਾਂ ਦਾ ਇਤਿਹਾਸ ਇਹ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਲਖਤੇ ਜਿਗਰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਜੋ ਕਿ ਛੇ ਅਤੇ ਨੌ ਸਾਲ ਦੀ ਉਮਰ ਦੇ ਸਨ ਇਹਨਾਂ ਨੇ ਮੁਗਲ ਰਜੀਨ ਜਿਹੜੀ ਸੀ ਉਸ ਸਮੇਂ ਦੀ ਔਰੰਗਜ਼ੇਬ ਦਾ ਦਿੱਲੀ ਤਖ਼ਤ 'ਤੇ ਰਾਜ ਅਤੇ ਇੱਥੇ ਸਰਹੰਦ ਸ਼ਹਿਰ ਦੇ ਬਾਦਸ਼ਾਹ ਵਜ਼ੀਰ ਖਾਨ ਇਹਨਾਂ ਦੀ ਹਕੂਮਤ ਦੇ ਅੰਦਰ ਜਦੋਂ ਉਹਨਾਂ ਨੂੰ ਕੈਦ ਕਰਕੇ ਲਿਆਉਂਦਾ ਗਿਆ ਤਾਂ ਅਤੇ ਆਪਣਾ ਧਰਮ ਬਦਲਣ ਲਈ ਕਿਹਾ ਅਤੇ ਇਹਨਾਂ ਨੇ ਮਨਾ ਕਰ ਦਿੱਤਾ ਸੀ ਅਤੇ ਵਜ਼ੀਰ ਖਾਨ ਨੇ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਅੰਦਰ ਜਿਉਂਦੇ ਜਾਗਦੇ ਇ ਇੱਟਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਇਹਨਾਂ ਦੀ ਯਾਦ ਅੰਦਰ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਅੰਦਰ ਫਿਰ ਉਸੇ ਸਥਾਨ 'ਤੇ ਜੋੜ ਮੇਲਾ ਲੱਗਦਾ ਹੈ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਹਨ ਕੀਰਤਨ ਦਰਬਾਰ ਹੁੰਦੇ ਹਨ ਸ਼ਬਦ ਗਾਏ ਜਾਂਦੇ ਹਨ ਅਤੇ ਹੋਰ ਬਹੁਤ ਤਰ੍ਹਾਂ ਤਰ੍ਹਾਂ ਦੇ ਸਮਾਗਮ ਦਸਤਾਰਬੰਦੀ ਗੱਤਕਾ ਢਾਡੀ ਵਾਰਾਂ ਲੰਗਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਲੰਗਰ ਲੱਗਦੇ ਹਨ ਜਿਨ੍ਹਾਂ ਦੇ ਅੰਦਰ ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦੇ ਸਾਰੇ ਪਿੰਡ ਨਾਲ ਹੋ ਕੇ ਇਕੱਠੇ ਹੋ ਕੇ ਸੇਵਾ ਕਰਦੇ ਹਨ ਅਤੇ ਪੂਰੇ ਦਸੰਬਰ ਦੇ ਮਹੀਨੇ ਸਿਰਫ ਇਹ ਆਖਰੀ ਹਫਤੇ ਦੇ ਲਈ ਤਿਆਰੀ ਚੱਲਦੀ ਹੈ ਅਤੇ ਹਰ ਧਰਮ ਦੇ ਲੋਕ ਆ ਕੇ ਨਾਲ ਰਲ ਮਿਲ ਕੇ ਇਕੱਠੇ ਹੋ ਕੇ ਇਹ ਜਿਹੜਾ ਆਖਰੀ ਹਫਤਾ ਇਹਨੂੰ ਮਨਾਉਂਦੇ ਹਨ ਅਤੇ ਪੂਰੀ ਦਸੰਬਰ ਦੇ ਅੰਦਰ ਕੋਈ ਵਿਆਹ ਵਗੈਰਾ ਇੱਦਾਂ ਦਾ ਕੋਈ ਵੀ ਜਿਹੜਾ ਸਮਾਗਮ ਹੁੰਦਾ ਉਹ ਨਹੀਂ ਰਚਾਇਆ ਜਾਂਦਾ ਇਹ ਸਾਰਾ ਮਹੀਨਾ ਹੈ ਜਿਹੜਾ ਇਹ ਰੱਬ ਨਾਲ ਜੁੜ ਕੇ ਭਗਤੀ ਭਾਵਨਾ ਨਾਲ ਬਤੀਤ ਕੀਤਾ ਜਾਂਦਾ ਇਹ ਤੋਂ ਇਲਾਵਾ ਪੂਰੇ ਸਾਲ ਦੇ ਅੰਦਰ ਵੀ ਹਰ ਮਹੀਨੇ ਕੋਈ ਨਾ ਕੋਈ ਕੀਰਤਨ ਸਮਾਗਮ ਜਾਂ ਹਿੰਦੂਆਂ ਦਾ ਕੋਈ ਨਾ ਕੋਈ ਜਗਰਾਤਾ ਹੁੰਦਾ ਰਹਿੰਦਾ ਹੈ ਅਤੇ ਸਾਲ ਦੇ ਅੰਦਰ ਇੱਕ ਵਾਰੀ ਵੀ ਪਾਕਿਸਤਾਨ ਤੋਂ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਮੁਸਲਮਾਨ ਜਿਹੜੀ ਇੱਥੇ ਦੀ ਬਹੁਤ ਜ਼ਿਆਦਾ ਜਾਣੀ ਜਾਂਦੀ ਸਰਹੰਦ ਦੀ ਮਸੀਤ ਹੈ ਉੱਥੇ ਮੁਸਲਮਾਨਾਂ ਦਾ ਮੇਲਾ ਲੱਗਦਾ ਜਿੱਥੇ ਉਹ ਮੁਸਲਮਾਨ ਆ ਕੇ ਇਕੱਠੇ ਹੁੰਦੇ ਹਨ ਅਤੇ ਇਸੇ ਤਰ੍ਹਾਂ ਹੀ ਇਹ ਸ਼ਹਿਰ ਦੇ ਅੰਦਰ ਹਿੰਦੂਆਂ ਦੇ ਮੁਸਲਮਾਨਾਂ ਦੇ ਅਤੇ ਖਾਸ ਕਰ ਸਿੱਖਾਂ ਦਾ ਜਿਹੜਾ ਸਮਾਗਮ ਹੈ ਉਹ ਸਾਰੇ ਮਨਾਏ ਜਾਂਦੇ ਹਨ